ਹੈਲੋ ਹਾਂਜੀ ਸ਼ਗਨ ਢਾਬੇ ਤੋਂ ਬੋਲਦੇ ਹੋ ਜੀ ਅੱਛਾ ਮੈਂ ਨਾ ਪਲੈਨ ਕਰ ਰਿਹਾ ਸੀਗਾ ਤੁਹਾਡੇ ਨਾ ਨੈਕਸਟ ਵੀਕ ਆਉਣ ਦਾ ਤੁਹਾਡੇ ਢਾਬੇ 'ਤੇ ਅਤੇ ਮੈਂ ਇਹ ਪੁੱਛਣਾ ਸੀਗਾ ਇੱਕ ਤਾਂ ਤੁਹਾਡੀ ਟਾਈਮਿੰਗ ਸ਼ਡਿਊਲ ਕੀ ਹੈ ਅਤੇ ਉਸ ਦੇ ਵਿੱਚ ਇੱਕ ਮੈਨੂੰ ਇਹ ਦੱਸੋ ਵੀ ਤੁਹਾਡੇ ਤੁਸੀਂ ਡਿਸ਼ ਵਗੈਰਾ ਕਿੰਨੇ ਪ੍ਰਕਾਰ ਦੀ ਕਿਹੜੀਆਂ ਡਿਸ਼ਾਂ ਦੇ ਸਕਦੇ ਹੋ ਅਤੇ ਮੈਨੂੰ ਟੇਬਲ ਦੀ ਤੁਹਾਨੂੰ ਮੈਂ ਟਾਈਮ ਦੱਸ ਦਿੰਦਾ ਵੀ ਮੈਨੂੰ ਇੰਨੇ ਤੋਂ ਲੈ ਕੇ ਇੰਨੇ ਤੱਕ ਟੇਬਲ ਚਾਹੀਦਾ ਤੁਹਾਨੂੰ ਤੁਸੀਂ ਮੈਨੂੰ ਉਪਲਬਧ ਕਰਵਾ ਸਕਦੇ ਹੋ ਇਸ ਟਾਈਮ 'ਤੇ ਟੇਬਲ ਅਤੇ ਉਸ ਟਾਈਮ ਦੇ ਵਿੱਚ ਮੈਨੂੰ ਪਾਰਕਿੰਗ ਵਗੈਰਾ ਦੀ ਕੋਈ ਦਿੱਕਤ ਨਾ ਹੋਵੇ ਤੇ ਕਾਫੀ ਰੀਲੇਟਿਵ ਆਉਣਗੇ ਮੇਰੇ ਠੀਕ ਹੈ ਅਤੇ ਮੈਨੂੰ ਦੱਸਿਓ ਇਹ ਕੰਫਰਮ ਕਰਕੇ